ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਗਗਨ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਜੀ ਮੈਨੂੰ ਕੁਛ ਔਡਰ ਤੁਹਾਡੇ ਰੈਸਟੋਰੈਂਟ ਤੋਂ ਕਰਵਾਉਣਾ ਸੀ ਹਾਂਜੀ ਜੇ ਤੁਸੀਂ ਜਲਦੀ ਔਡਰ ਪਹੁੰਚਾਉਣ ਦਾ ਵਾਅਦਾ ਕਰੋ ਤਾਂ ਫਿਰ ਹੀ ਮੈਂ ਔਡਰ ਦੇਵਾਂ ਵਰਨਾ ਕਿਸੇ ਹੋਰ ਰੈਸਟੋਰੈਂਟ ਤੋਂ ਨਹੀਂ ਜੀ ਜ਼ਰਾ ਕੁਛ ਜਲਦੀ ਸੀਗੀ ਇਸ ਕਰਕੇ ਹਾਂਜੀ ਹਾਂਜੀ ਠੀਕ ਹੈ ਜੀ ਪਰ ਮੈਨੂੰ ਔਡਰ ਅੱਧੇ ਘੰਟੇ ਤੀਕਰ ਚਾਹੀਦਾ ਹਾਂਜੀ ਬਸ ਨਾ ਮੈਨੂੰ ਔਡਰ ਵਿੱਚ ਜੋ ਮੈਂ ਲੰਚ 'ਚ ਮੰਗਵਾਉਣ ਲੱਗੀ ਹਾਂ ਪਰ ਮੈਨੂੰ ਨਾ ਉਸ 'ਚ ਮਿਰਚ ਵਗੈਰਾ ਜ਼ਿਆਦਾ ਨਹੀਂ ਚਾਹੀਦੀ ਹਾਂਜੀ ਖਾਣੇ 'ਚ ਮਿਰਚ ਨਾ ਹੋਵੇ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਧੇ ਘੰਟੇ 'ਚ ਹੋ ਜਾਏਗਾ ਜੀ ਠੀਕ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰਿਓ ਕਿ ਔਡਰ ਲਿਖ ਲਓ ਹਾਂਜੀ ਵੀਹ ਮੱਖਣੀ ਨਾਨ ਜੀ ਵੀਹ ਟਵੰਟੀ ਹਾਂਜੀ ਵੀਹ ਵੀਹ ਮੱਖਣੀ ਨਾਨ ਇੱਕ ਫੁੱਲ ਪਲੇਟ ਦਾਲ ਮੱਖਣੀ ਇੱਕ ਫੁੱਲ ਪਲੇਟ ਸ਼ਾਹੀ ਪਨੀਰ ਦੀ ਇੱਕ ਪਲੇਟ ਮਿਕਸ ਸਬਜ਼ੀ ਅਤੇ ਸਵੀਟ ਡਿਸ਼ ਵਿੱਚ ਇਸ ਤਰ੍ਹਾਂ ਕਰਿਓ ਕਿ ਤੁਸੀਂ ਰਸਮਲਾਈ ਲਿਖ ਲਓ ਅਤੇ ਹਾਂਜੀ ਰਸਮਲਾਈ ਅਤੇ ਸਲਾਦ ਵਿੱਚ ਤੁਸੀਂ ਇਸ ਤਰ੍ਹਾਂ ਕਰਿਓ ਕਿ ਸਿੰਪਲ ਸੈਲਡ ਨਾਲ ਭੇਜ ਦਿਓ ਜਾਂ ਕੋਈ ਖਾਲੀ ਮੂਲੀ ਵਗੈਰਾ ਜਾਂ ਖੀਰਾ ਵਗੈਰਾ ਨਾਲ ਭੇਜ ਦੇਣਾ ਮਿਕਸ ਸਲੈ ਸੈਲਡ ਹਾਂਜੀ ਹਾਂਜੀ ਮਿਕਸ ਚੁਕੰਦਰ ਵਗੈਰਾ ਵੀ ਹੋਵੇ ਉਹਦੇ ਵਿੱਚ ਠੀਕ ਹੈ ਜੀ ਬਸ ਤੁਸੀਂ ਅੱਧੇ ਘੰਟੇ ਤੱਕ ਮੈਨੂੰ ਪਹੁੰਚਾ ਦੇਣਾ ਹਾਂਜੀ ਜੀ ਸਾਡਾ ਘਰ ਤੁਹਾਡੇ ਰੈਸਟੋਰੈਂਟ ਤੋਂ ਨੇੜੇ ਹੀ ਹੈਗਾ ਔਡਰ ਜਲਦੀ ਪਹੁੰਚ ਹੀ ਜਾਵੇਗਾ ਹਾਂਜੀ ਜੀ ਮੈਂ ਤੁਹਾਨੂੰ ਆਪਣਾ ਐਡਰੈੱਸ ਲਿਖਵਾ ਦਿੰਦੀ ਹਾਂ ਅਤੇ ਤੁਸੀਂ ਹਾਂਜੀ ਹਾਂਜੀ ਨੋਟ ਕਰ ਲਓ ਹਾਂਜੀ ਬਸ ਖਾਣਾ ਵਧੀਆ ਤਰੀਕੇ ਨਾਲ ਪੈਕ ਹੋਵੇ ਜੀ ਹਾਂਜੀ ਠੀਕ ਹੈ ਜੀ ਬਸ ਤੁਸੀਂ ਇਸ ਤਰ੍ਹਾਂ ਕਰਿਓ ਡਰੈੱਸ ਨੋਟ ਕਰ ਲਓ ਸਰਦਾਰ ਸਰਬਜੀਤ ਸਿੰਘ ਹਾਂਜੀ ਹੰਜੀ ਸਰਬਜੀਤ ਸਿੰਘ ਜੀ ਸਰਦਾਰ ਸਰਬਜੀਤ ਸਿੰਘ ਦੀਪ ਐਵਨਿਊ ਗਲੀ ਨੰਬਰ ਚਾਰ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਨਾ ਇਹ ਤੁਹਾਡੇ ਬਿਲਕੁਲ ਰੈਸਟੋਰੈਂਟ ਦੇ ਨਾਲ ਹੀ ਹੈਗਾ ਚਾਰ ਕੁ ਗਲੀਆਂ ਛੱਡ ਕੇ ਹਾਂਜੀ ਬਸ ਤੁਸੀਂ ਲੇਟ ਨਾ ਕਰਿਓ ਬਸ ਇਹ ਨਾ ਹੋਵੇ ਕਿ ਮੈਂ ਅੱਧੇ ਘੰਟੇ ਦਾ ਤੁਸੀਂ ਮੇਰੇ ਤੋਂ ਟਾਈਮ ਲਿਤਾ ਹੈ ਪਰ ਤੁਸੀਂ ਇੱਕ ਘੰਟੇ ਬਾਅਦ ਭੇਜੋ ਨਹੀਂ ਜੀ ਬਿਲਕੁਲ ਮੈਨੂੰ ਅੱਧੇ ਘੰਟੇ ਤੀਕਰ ਹੀ ਚਾਹੀਦਾ ਹੈਗਾ ਮੈਂ ਤੁਹਾਨੂੰ ਇਸ ਕਰਕੇ ਪਹਿਲਾਂ ਪੁੱਛਿਆ ਸੀ ਕਿ ਜੇ ਅੱਧੇ ਘੰਟੇ ਤੀਕਰ ਤੁਹਾਡੇ ਤੋਂ ਹੋ ਸਕਦਾ ਹੈ ਅਤੇ ਫਿਰ ਮੈਂ ਤੁਹਾਨੂੰ ਔਡਰ ਲਿਖਵਾ ਦੇਵਾਂ ਵਰਨਾ ਕਿਸੇ ਹੋਰ ਰੈਸਟੋਰੈਂਟ ਤੋਂ ਔਡਰ ਲੈ ਲੈਂਦੀ ਹਾਂ ਹਾਂਜੀ ਜੀ ਬਸ ਤੁਸੀਂ ਹਾਂਜੀ ਪਲੀਸ ਹਾਂਜੀ ਜੀ ਸ਼ੁਕਰੀਆ ਠੀਕ ਹੈ ਜੀ ਮੈਂ ਤੁਹਾਨੂੰ ਟਵੰਟੀ ਫਾਈਵ ਮਿਨਟਸ ਬਾਅਦ ਦੁਬਾਰਾ ਕੌਲ ਕਰਦਾਂਗੀ ਹਾਂਜੀ ਠੀਕ ਹੈ ਜੀ ਜਦੋਂ ਜੇ ਆ ਗਿਆ ਔਡਰ ਡਿਲਿਵਰ ਕਰਨ ਵਾਸਤੇ ਤਾਂ ਮੈਨੂੰ ਬੈਕ ਕੌਲ ਕਰ ਦਿਓ ਅਤੇ ਮੈਂ ਬਾਹਰੋਂ ਲੈ ਲਵਾਂਗੀ ਉਹਨਾਂ ਕੋਲੋਂ ਠੀਕ ਹੈ ਜੀ ਧੰਨਵਾਦ